ਸਤਿ ਸ਼੍ਰੀ ਅਕਾਲ ਜੀ ਤੁਸੀਂ ਪੁੱਛਿਆ ਨਾ ਕਿ ਭੰਗੜਾ ਐਰੋਬਿਕਸ ਲਈ ਕੋਈ ਖਾਸ ਮੁਕਾਬਲੇ ਹਨ ਹਾਂਜੀ ਖਾਸ ਮੁਕਾਬਲੇ ਹੁੰਦੇ ਨੇ ਟੀਮਾਂ ਬਣਾਈਆਂ ਜਾਂਦੀਆਂ ਟੀਮਾਂ ਦੇ ਨਾਲ ਮੁਕਾਬਲੇ ਹੁੰਦੇ ਨੇ ਅਤੇ ਮੁਕਾਬਲਿਆਂ ਵਿੱਚ ਇੱਕ ਤਾਂ ਇੰਜੋਇਮੈਂਟ ਹੁੰਦਾ ਏ ਬੱਚੇ ਵਧੀਆ ਮਹਿਸੂਸ ਕਰਦੇ ਨੇ ਇੱਕ ਮਾਨਸਿਕ ਅਤੇ ਸਰੀਰਕ ਫਰੀ ਫਰੀ ਮਹਿਸੂਸ ਕਰਦੇ ਨੇ ਟੈਂਸ਼ਨ ਫਰੀ ਹੋ ਜਾਂਦਾ ਇਨਸਾਨ ਬਹੁਤ ਵਧੀਆ ਲੱਗਦਾ ਕਈ ਜਗ੍ਹਾ 'ਤੇ ਮੁਕਾਬਲੇ ਹੁੰਦੇ ਨੇ ਸ਼ਹਿਰਾਂ ਵਿੱਚ ਤਕਰੀਬਨ ਮੁਕਾਬਲੇ ਹੁੰਦੇ ਰਹਿੰਦੇ ਨੇ ਅਤੇ ਵਧੀਆ ਲੱਗਦਾ ਹੈ ਬਹੁਤ ਵਧੀਆ ਹਰ ਇੱਕ ਨੂੰ ਇਹ ਮੁਕਾਬਲੇ ਕਰਾਉਣੇ ਚਾਹੀਦੇ ਹਨ ਕਿ ਇੱਦਾਂ ਸਾਡੇ ਸਰੀਰਕ ਅਤੇ ਮਾਨਸਿਕ ਫਰੀ ਫਰੀ ਮਹਿਸੂਸ ਹੁੰਦੇ ਆ ਵਧੀਆ ਮਹਿਸੂਸ ਹੁੰਦਾ ਸਾਨੂੰ ਵਧੀਆ ਲੱਗਦਾ ਇਹ ਇੱਕ ਨਵਾਂ ਸਿਸਟਮ ਚੱਲ ਗਿਆ ਬਹੁਤ ਵਧੀਆ ਲੱਗਦਾ ਏ ਇੱਦਾਂ ਕਰਾਉਣਾ ਵਧੀਆ ਲੱਗਦਾ ਹੈ ਅਤੇ ਹਰ ਇੱਕ ਨੂੰ ਇੱਦਾਂ ਕਰਨਾ ਚਾਹੀਦਾ ਹੈ ਕਿ ਭੰਗੜੇ ਦੇ ਨਾਲ ਅਸੀਂ ਅਤੇ ਐਰੋਬਿਕਸ ਨਾਲ ਸਾਡਾ ਸਰੀਰ ਵੀ ਸਹੀ ਰਹਿੰਦਾ ਏ ਅਤੇ ਮਾਨ ਮਨ ਦਿਮਾਗ ਵੀ ਸਹੀ ਰਹਿੰਦਾ ਏ ਵੀ ਰਿਲੈਕਸ ਫੀਲ ਕਰਦੇ ਹਾਂ ਅਸੀਂ ਬਹੁਤ ਵਧੀਆ ਲੱਗਦਾ ਸਾਨੂੰ ਇੱਦਾਂ ਦੇ ਮੁਕਾਬਲੇ ਹੁੰਦੇ ਰਹਿੰਦੇ ਨੇ ਅਤੇ ਬਹੁਤ ਵਧੀਆ ਲੱਗਦਾ ਇੱਦਾਂ ਮੁਕਾਬਲਾ ਹੋਣ ਦੇ ਨਾਲ ਅਤੇ ਹਰ ਇੱਕ ਨੂੰ ਇੱਦਾਂ ਦੇ ਇ ਇੱਦਾਂ ਦੇ ਮੁਕਾਬਲਿਆਂ 'ਚ ਭਾਗ ਲੈਣਾ ਚਾਹੀਦਾ ਏ ਅਤੇ ਵਧੀਆ ਲੱਗਦਾ ਇੱਦਾਂ ਇੰਜੋਇਮੈਂਟ ਵੀ ਹੁੰਦੀ ਹੈ ਅਤੇ ਸਰੀਰ ਵੀ ਸਹੀ ਰਹਿੰਦਾ ਏ ਦਿਮਾਗ ਵੀ ਸਹੀ ਰਹਿੰਦਾ ਏ ਅਤੇ ਇੱਕ ਨਵਾਂਪਣ ਆਉਂਦਾ ਜ਼ਿੰਦਗੀ